ਤਿੰਨ ਮਾਰਚ ਦੋ ਹਜ਼ਾਰ ਪੰਜ ਬਾਈ ਜਨਵਰੀ ਦੋ ਹਜ਼ਾਰ ਚਾਰ ਬਾਰਾਂ ਅਕਤੂਬਰ ਦੋ ਹਜ਼ਾਰ ਤੇਰਾਂ ਪੱਚੀ ਨਵੰਬਰ ਦੋ ਹਜ਼ਾਰ ਸੱਤ ਬਾਰਾਂ ਮਈ ਦੋ ਹਜ਼ਾਰ ਚੌਵੀ